ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਅਧਿਆਪਕਾਂ ਦੀ ਘਾਟ ਤਾਂ ਹੈਗੀ ਹੈ ਕਿਉਂਕਿ ਅਧਿਆਪਕ ਸਮੇਂ ਸਮੇਂ 'ਤੇ ਸਰਕਾਰ ਰੱਖਦੀ ਨਹੀਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਵਿਦਿਆਰਥੀਆਂ ਦਾ ਪੜ੍ਹਾਈ 'ਚ ਰੁਝਾਨ ਜ਼ਿਆਦਾ ਹੁੰਦਾ ਉਹ ਵੀ ਹਟ ਜਾਂਦਾ ਹੈ ਅਤੇ ਇਸ ਕਰਕੇ ਵੀ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾ ਦਿੰਦੇ ਹਨ ਪਰ ਜੇ ਡਸਿਪਲਿਨ ਜ਼ਿਆਦਾ ਰੱਖਿਆ ਜਾਵੇ ਤਾਂ ਅਨੁਸ਼ਾਸਨ ਜ਼ਿਆਦਾ ਰੱਖਿਆ ਜਾਵੇ ਤਾਂ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਛੁੱਟੀ ਹੈ ਜਾਂ ਜਿਹੜੀ ਗੈਰ ਹਾਜ਼ਰੀ ਆ ਉਹਨੂੰ ਸੀਰੀਅਸਲੀ ਲਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਟੀਚਰ ਇਹੋ ਜਿਹੇ ਨੇ ਜਿਹੜੇ ਕਿ ਬਾਹਰ ਜਾ ਰਹੇ ਨੇ ਇੱਥੋਂ ਛੁੱਟੀ ਲੈ ਕੇ ਕਨੇਡਾ ਜਾਂ ਅਮਰੀਕਾ ਚਲੇ ਜਾਂਦੇ ਹਨ ਨਾ ਤਾਂ ਉਹ ਗੌਰਮੈਂਟ ਪੋਸਟ ਭਰਦੀ ਹੈ ਨਾ ਹੀ ਉਹਨਾਂ ਦੇ ਖਿਲਾਫ ਕੋਈ ਕਿਹੜੇ ਬੰਦੇ ਛੁੱਟੀ ਲੈ ਕੇ ਗ ਗਏ ਨੇ ਅਤੇ ਜੁਆਇਨ ਨਹੀਂ ਕਰਦੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੀ ਹੈ